ਹਾਂਜੀ ਮੈਂ ਇੱਥੇ ਤੁਹਾਡੇ ਨਾ ਗਲੀ 'ਚੋਂ ਹੀ ਬੋਲਦਾ ਤੁਹਾਨੂੰ ਇੱਕ ਵਾਰ ਤੁਹਾਨੂੰ ਇੱਕ ਵਾਰ ਪਹਿਲਾਂ ਮਿਲਿਆ ਸੀਗਾ ਮੈਂ ਅਤੇ ਤੁਹਾਡਾ ਨੰਬਰ ਲਿੱਤਾ ਸੀਗਾ ਹਾਂਜੀ ਮੈਂ ਨਵਾਂ ਆਇਆ ਸੀਗਾ ਹਾਂਜੀ ਹਾਂਜੀ ਅਤੇ ਮੈਂ ਅਤੇ ਅਸੀਂ ਨਾ ਇੱਥੇ ਮੁਕਤਸਰ ਨਾ ਮੇਰੇ ਹੁਣ ਇੱਥੇ ਉਹ ਹੋਈ ਸੀ ਨਾ ਟ੍ਰਾਂਸਫਰ ਹੋਇਆ ਤਾਂ ਕਰਕੇ ਅਤੇ ਮੈਂ ਇੱਥੇ ਨਾ ਘੁੰਮਣ ਵਾਸਤੇ ਜਾਣਾ ਸੀ ਮੈਨੂੰ ਦੋ ਤਿੰਨ ਵਾਸਤੇ ਛੁੱਟੀਆਂ ਸੀ ਦੀਵਾਲੀ ਦੀਆਂ ਅਤੇ ਉਹਦੇ ਵਾਸਤੇ ਮੈਂ ਟ੍ਰਿਪ ਕਰਨੀ ਸੀਗੀ ਕਿ ਇੱਥੇ ਲੋਕਲ ਤੁਸੀਂ ਦੱਸ ਸਕਦੇ ਹੋ ਕਿਹੜੀ ਕਿਹੜੀ ਜਗ੍ਹਾ 'ਤੇ ਘੁੰਮ ਸਕਦੇ ਹਾਂ ਹਾਂਜੀ ਹਾਂ ਹਾਂਜੀ ਹਾਂਜੀ

ਹਾਂਜੀ ਇਹ ਕਿਹੜੇ ਸਾਈਡ ਪੈ ਜਾਂਦਾ ਮੁਕਤੇ ਮਿਨਾਰ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹਾਂਜੀ ਸੁਣਿਆ ਹੋਇਆ ਇਹਦੇ ਬਾਰੇ ਮੈਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਠੀਕ ਹੈ ਹੋਰ ਸਭ ਠੀਕ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ